ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦੇ ਨਾ ਆਪਣੇ ਗੁਰਦੁਆਰਾ ਸਾਹਿਬ ਦੀ ਭੇਟਾ ਠੀਕ ਹੈ ਜੀ ਗੱਲ ਇੱਦਾਂ ਜੀ ਜਿਹੜੀ ਭੇਟਾ ਜੀ ਇੱਥੇ ਹੈਗੀ ਪਚਾਨਵੇਂ ਸੋ ਰੁਪਈਆ ਜੀ ਉਸਦੇ ਉਸਦੇ ਵਿੱਚ ਰੁਮਾਲਾ ਸਾਹਿਬ ਗੁਰਦੁਆਰਾ ਸਾਹਿਬ ਦਾ ਹੋਊਗਾ ਦੇਗ ਹੋਏਗੀ ਅਤੇ ਉਸ ਤੋਂ ਬਾਅਦ ਜੇ ਲੰਗਰ ਦਾ ਤੁਸੀਂ ਕਰਨਾ ਲੰਗਰ ਦਾ ਤੁਸੀਂ ਇਹ ਦੇਖਣਾ ਵੀ ਤੁਸੀਂ ਲੰਗਰ ਆਪ ਦੇਣਾ ਜਾਂ ਤੁਸੀਂ ਮਾਇਆ ਦੇਣੀ ਹੈ ਹਾਂਜੀ ਹਾਂ ਲੰਗਰ ਦੇ ਦਾ ਐਕਸਟਰਾ ਹੁੰਦਾ ਜੀ ਲੰਗਰ ਵਿੱਚ ਜੋ ਵੀ ਤੁਸੀਂ ਕਹੋਗੇ ਬਣਾਉਣਾ ਤੁਸੀਂ ਆਪ ਲੈ ਕੇ ਆਉਣਾ ਤੁਸੀਂ ਆਪ ਲਿਆ ਦੇ ਸਕਦੇ ਲੈ ਕੇ ਜਾਂ ਫਿਰ ਤੁਸੀਂ ਮਾਇਆ ਦੇ ਸਕਦੇ ਹੋ ਮਾਇਆ ਦੇ ਵਿੱਚ ਤੁਸੀਂ ਕੀ ਲੰਗਰ ਬਣਾਉਣਾ ਉਹ ਸਾਨੂੰ ਦੱਸ ਸਕਦੇ ਹੋ ਵੀ ਅਸੀਂ ਆਹ ਲੰਗਰ ਬਣਾਉਣਾ ਉਹ ਅਸੀਂ ਲੰਗਰ ਤਿਆਰ ਕਰਵਾ ਦੇਵਾਂਗੇ ਹਾਂਜੀ ਸਹਿਜ ਪਾਠ ਬਹੁਤ ਘੱਟ ਹੁੰਦੇ ਜੀ ਅਖੰਡ ਪਾਠ ਸਾਹਿਬ ਜ਼ਿਆਦਾ ਹੁੰਦੇ ਆ ਜੀ ਜ਼ਿਆਦਾ ਜਦੋਂ ਵੀ ਤੁਸੀਂ ਚਾਹੋ ਜਦ ਵੀ ਤੁਸੀਂ ਚਾਹੋ ਜੀ ਉਦੋਂ ਅਸੀਂ ਡੇ ਡੇਟ ਦੇ ਦੇਵਾਂਗੇ ਜੀ ਤੁਹਾਨੂੰ ਨਹੀਂ ਜੀ ਨਹੀਂ ਤੁਹਾਨੂੰ ਬੁੱਕ ਕਰਵਾਉਣਾ ਪਏਗਾ ਬੁੱਕ ਕਰਵਾ ਕੇ ਅਤੇ ਅਸੀਂ ਤੁਹਾਨੂੰ ਡੇਟ ਦੇਵਾਂਗੇ ਡੇਟ ਦੇਖ ਕੇ ਤੁਸੀਂ ਜਿਸ ਦਿਨ ਆਰੰਭ ਹੋਣਾ ਉਸ ਦਿਨ ਤੁਸੀਂ ਆ ਸਕਦੇ ਹੋ ਅਤੇ ਫਿਰ ਤੁਹਾਨੂੰ ਬ ਬਕਾਇਦਾ ਅਸੀਂ ਕਮਰਾ ਵੀ ਦੇਵਾਂਗੇ ਰਹਿਣ ਰਿਹਾਇਸ਼ ਵਾਸਤੇ ਅਤੇ ਤੀਜੇ ਦਿਨ ਫਿਰ ਅਖੰਡ ਸਾਹਿਬ ਦਾ ਭੋਗ ਪਏਗਾ ਉਸ ਤੋਂ ਬਾਅਦ ਲੰਗਰ ਪਾਣੀ ਹੋਏਗਾ ਜੀ ਜੋ ਕੁਛ ਤੁਸੀਂ ਕਹੋਗੇ ਅਸੀਂ ਉਹ ਲੰਗਰ ਪਾਣੀ ਤਿਆਰ ਕਰਵਾ ਦੇਵਾਂਗੇ ਸੰਗਤ ਵਾਸਤੇ ਹਾਂਜੀ ਹਾਂ ਕੋਈ ਗੱਲ ਨਹੀਂ ਜੀ ਜਦੋਂ ਮਰਜ਼ੀ ਆਓ ਵੈਲਕਮ ਜੀ ਆਇਆ ਨੂੰ ਜੀ ਹਾਂਜੀ ਹਾਂ ਠੀਕ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ